ਵੀਰੇ ਸਤਿ ਸ਼੍ਰੀ ਅਕਾਲ ਹੋਰ ਵੀਰ ਜੀ ਕੀ ਹਾਲ ਚਾਲ ਹੈ ਘਰ ਪਰਿਵਾਰ ਸਭ ਠੀਕ ਠਾਕ ਹਾਂ ਵੀਰੇ ਮੈਂ ਮਨਜੀਤ ਬੇਨਤੀ ਕਰਦਾ ਹਾਂ ਪਿੰਡ ਖਾਈ ਫਿਮੇਕੀ ਤੋਂ ਹਾਂਜੀ ਹਾਂਜੀ ਹੋਰ ਪਰਿਵਾਰ ਸਭ ਠੀਕ ਠਾਕ ਹੈ ਯਾਰ ਵੀਰ ਬੇਨਤੀ ਸੀ ਇੱਕ ਹਾਂਜੀ ਨਹੀਂ ਨਹੀਂ ਹੁਕਮ ਤਾਂ ਨਹੀਂ ਵੀਰੇ ਬੇਨਤੀ ਹੈ ਆਪਣੀ ਅਸੀਂ ਹੁਕਮ ਨਹੀਂ ਕਰ ਸਕਦੇ ਅਸੀਂ ਤਾਂ ਭਰਾ ਬੇਨਤੀ ਕਰ ਸਕਦੇ ਹਾਂ ਹਾਂ ਵੀਰੇ ਇੱਕ ਨਾ ਯਾਰ ਸਿਲਿੰਡਰ ਬੁੱਕ ਕਰਵਾਇਆ ਸੀ ਆਪਾਂ ਅਤੇ ਉਹ ਵੀਰੇ ਪਹੁੰਚਿਆ ਨਹੀਂ ਯਾਰ ਅਜੇ ਤੱਕ ਅਤੇ ਹੁਣ ਸਲੰਡਰ ਖ਼ਤਮ ਹੋ ਗਿਆ ਅਤੇ ਬੜਾ ਔਖਾ ਹੋਇਆ ਕੰਮ ਰੋਟੀ ਤੋਂ ਵੀ ਬੈਠੇ ਹੋਏ ਹਾਂ ਅਤੇ ਬੇਨਤੀ ਹੈ ਕੋਈ ਨਾ ਕੋਈ ਸੈਟਿੰਗ ਕਰ ਯਾਰ ਫਿਰ ਉਹਨੂੰ ਕਿੱਦਾਂ ਕਰੀਏ ਆਪਾਂ ਹਾਂ ਬਰੋਕਰਾਂ ਅੱਜ ਲਗਭਗ ਮੇਰੇ ਹਿਸਾਬ ਨਾਲ ਹਫ਼ਤਾ ਦਸ ਦਿਨ ਹੋ ਗਏ ਨੇ ਹਾਂ ਹਫ਼ਤਾ ਦਸ ਦਿਨ ਹੋ ਗਏ ਨੇ ਨਹੀਂ ਯਾਰ ਮੈਨੂੰ ਰੈਫਰ ਨੰਬਰ ਵੀ ਮਿਲਿਆ ਹੋਇਆ ਪਰ ਸਲੰਡਰ ਨਹੀਂ ਪਹੁੰਚਿਆ ਅਜੇ ਤੱਕ ਹਾਂ ਵੀਰੇ ਬੜੀ ਮਿਹਰਬਾਨੀ ਤੇਰੀ ਕੋਈ ਨਾ ਕੋਈ ਹੀਲਾ ਵਸੀਲਾ ਕਰ ਨਹੀਂ ਤਾਂ ਭਰਾ ਕੱਲ੍ਹ ਸਵੇਰੇ ਰੋਟੀ ਨਹੀਂ ਮਿਲਣੀ ਗੀ ਹਾਂ ਹਾਂ ਹਾਂਜੀ ਜ਼ਰੂਰੀ ਹੈ ਵੀਰੇ ਬਹੁਤ ਜ਼ਰੂਰੀ ਐ ਨਹੀਂ ਨਹੀਂ ਵੀਰੇ ਇੱਦਾਂ ਦੀ ਕੋਈ ਚੱਕਰ ਨਹੀਂ ਬਲੈ ਬਿਲਕੁਲ ਟਾਈਮ 'ਤੇ ਬੁੱਕ ਕਰਵਾਇਆ ਸੀ ਪਰ ਉਹਨੂੰ ਕੀ ਪਤਾ ਹੁਣ ਕਿਹੜੀ ਵਜ੍ਹਾ ਕਰਕੇ ਸਲੰਡਰ ਪਹੁੰਚਿਆ ਨਹੀਂ ਗਾ ਹਾਂ ਪਹੁੰਚਦਾ ਕਰਦੇ ਵੀਰ ਬਣ ਕੇ ਯਾਰ ਹੈ ਹਾਂਜੀ ਹਾਂਜੀ ਜੇ ਤਾਂ ਹੁਣ ਪਹੁੰਚਦਾ ਬੜੀ ਮਿਹਰਬਾਨੀ ਹੈ ਨਹੀਂ ਤਾਂ ਫਿਰ ਸਵੇਰੇ ਪਹਿਲੇ ਟਾਈਮ ਹੀ ਪਹੁੰਚਾ ਦੇਈਂ ਹੈ ਹਾਂ ਜ਼ਰੂਰ ਹੋਰ ਠੀਕ ਹੈ ਵੀਰੇ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੇਰੀ